ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਕੀ ਕਰੀ ਜਾਂਦੇ ਸਰ ਮੈਂ ਵੀ ਤੁਹਾਨੂੰ ਤਾਂ ਹੀ ਫੋਨ ਕੀਤਾ ਸੀਗਾ ਕਿ ਆਪਾਂ ਨਾ ਇੱਧਰ ਸ਼ਿਫਟ ਹੋਣ ਦੀ ਸੋਚਦੇ ਪਏ ਕਪੂਰਥਲਾ ਤਾਂ ਬੱਚਿਆਂ ਨੂੰ ਇੱਧਰ ਫਿਫਥ ਸਟੈਂਡਰਡ 'ਚ ਐਡਮਿਸ਼ਨ ਕਰਾਉਣੀ ਹੈ ਅਤੇ ਮੈਨੂੰ ਗਾਈਡ ਕਰੋ ਵੀ ਕਿਹੜਾ ਸਕੂਲ ਬੈਸਟ ਹੈ ਇੱਥੇ ਦਾ ਹਾਂਜੀ ਫਿਫਥ 'ਚ ਹੋਣਾ ਹੈ ਇੱਥੇ ਕੇ ਵੀ 'ਚ ਪੜ੍ਹਦੇ ਹੈ ਫਿਰ ਤਾਂ ਇਹ ਲੋਕਲ ਦੇ ਸ਼ੇ ਸ਼ਿਫਟ ਜਲੰਧਰ ਹੋਣਾ ਇੱਧਰ ਹੋਣਾ ਕਪੂਰਥਲੇ ਫਿਰ ਤੁਹਾਡੇ ਤਾਂ ਫਿਰ ਦੱਸੋ ਅੱਛਾ ਜੀ ਨਹੀਂ ਕੇ ਵੀ ਨਹੀਂ ਕੋਈ ਹੋਰ ਜਿੱਦਾਂ ਕੋਈ ਪ੍ਰਾਈਵੇਟ ਸਕੂਲ ਹੋ ਜਾਵੇ ਕੋਈ ਵਧੀਆ ਵਾਲਾ ਅੱਛਾ ਜੀ ਠੀਕ ਹੈ ਜੀ

ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ

ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਆ ਮੈਂ ਤੁਹਾਨੂੰ ਫਿਰ ਕਰਦਾ ਕੋਲ ਠੀਕ ਹੈ ਜੀ ਬਾਹਰੋਂ ਠੀ ਓਕੇ ਜੀ ਓਕੇ